ਹਾਂਜੀ ਮੈਂ ਆਟੋਮੈਟਿਕ ਅਨੁਵਾਦ ਦੀ ਵਰਤੋਂ ਕੀਤੀ ਹੈ ਅਤੇ ਗੂਗਲ ਮੈਪਸ ਦੀ ਵਰਤੋਂ ਵੀ ਕੀਤੀ ਹੈ ਜਿਸ ਵਿੱਚ ਮੈਂ ਆਟੋਮੈਟਿਕ ਅਨੁਵਾਦ ਵਿੱਚ ਗੂਗਲ ਟਰਾਂਸਲੇਟਰ ਦੀ ਵਰਤੋਂ ਕੀਤੀ ਹੈ ਜਿਵੇਂ ਕਿ ਮੈਨੂੰ ਇਸ ਵਿੱਚ ਮੈਨੂੰ ਕਿਸੇ ਵੀ ਭਾਸ਼ਾ ਨੂੰ ਸਿੱਖਣ ਵਿੱਚ ਮਦਦ ਮਿਲਦੀ ਹੈ ਮੈਂ ਕਿਸੇ ਕੰਟਰੀ ਵਿੱਚ ਗਈ ਸੀ ਉੱਥੇ ਮੈਨੂੰ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ ਸੀ ਓ ਉਸ ਵਕਤ ਮੈਂ ਗੂਗਲ ਟਰਾ ਟਰਾਂਸਲੇਟਰ ਦੀ ਵਰਤੋਂ ਕੀਤੀ ਜਿਸ ਵਿੱਚ ਮੈਂ ਉਹਨਾਂ ਦੀ ਭਾਸ਼ਾ ਨੂੰ ਆਪਣੀ ਭਾਸ਼ਾ ਵਿੱਚ ਬਦਲ ਲਿਆ ਗੂਗ ਗੂਗਲ ਮੈਪਸ ਦੀ ਵਰਤੋਂ ਮੈਂ ਬਹੁਤ ਕਦੀ ਵੀ ਕਦੀ ਵੀ ਮੈਂ ਜਦੋਂ ਕਿਤੇ ਜਾਂਦੀ ਹਾਂ ਕਿਤੇ ਦੂਰ ਜਾਂਦੀ ਹਾਂ ਜਾਂ ਕਿਸੇ ਅਣਜਾਣ ਰਾਹ ਜਿਸ 'ਤੇ ਮੈਂ ਪਹਿਲੀ ਵਾਰ ਜਾਣਾ ਹੋਵੇ ਉੱਥੇ ਮੈਂ ਗੂਗਲ ਮੈਪਸ ਦੀ ਵਰਤੋਂ ਕਰਦੀ ਹਾਂ ਜਿਸ ਵਿੱਚ ਮੈਨੂੰ ਕੋਈ ਵੀ ਰਸਤਾ ਸ਼ਹਿਰ ਦੀ ਕੋਈ ਗਲੀ ਜਾਂ ਉਹ ਮੈਨੂੰ ਪਤਾ ਲੱਗ ਸਕੇ ਅਤੇ ਮੈਂ ਚਾਹੁੰਦੀ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਹੋਰ ਐਪਸ ਬਣਨ ਇਹ ਬਹੁਤ ਹੀ ਸਹੀ ਹਨ ਧੰਨਵਾਦ ਜੀ